ਮੈਨੂੰ ਰੀਲਾਂ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਮੈਂ ਆਪਣੇ ਫ਼ੋਨ ਦੇ ਵਿੱਚ ਹੀ ਰੀਲਾਂ ਬਣਾਉਂਦਾ ਹਨ ਅਤੇ ਮੈਂ ਆਪਣੇ ਡੇਲੀ ਇੰਸਟਾਗ੍ਰਾਮ 'ਤੇ ਨਵੀਂ ਨਵੀਂ ਰੀਲਾਂ ਪਾਉਂਦਾ ਹਨ ਨਵੇਂ ਨਵੇਂ ਗਾਣੇ ਪਾ ਕੇ ਅਤੇ ਉਸ ਤੋਂ ਬਾਅਦ ਮੇਰੇ ਮਤਲਬ ਇੰਸਟਾਗ੍ਰਾਮ 'ਤੇ ਟੈੱਨ ਕੇ ਫੋਲੋਵਰ ਹਨ ਅਤੇ ਮੈਨੂੰ ਰੀਲਾਂ ਦੇ ਵਿੱਚ ਜ਼ਿਆਦਾ ਸ਼ੌਂਕ ਹੈ ਕਿਉਂਕਿ ਰੀਲਾਂ ਦੇ ਵਿੱਚ ਸਾਨੂੰ ਵੱਖਰੇ ਵੱਖਰੇ ਤਰ੍ਹਾਂ ਨਾਲ ਪੋਜ਼ ਕਰਨੇ ਪੈਂਦੇ ਹਨ ਚੱਲਣਾ ਪੈਂਦਾ ਹਨ ਡਾਂਸ ਵੀ ਕਰਨਾ ਪੈਂਦਾ ਹੈ ਅਤੇ ਫੋਟੋਆਂ ਦੇ ਵਿੱਚ ਸਾਨੂੰ ਇੱਕ ਜਗ੍ਹਾ 'ਤੇ ਖੜ੍ਹ ਕੇ ਅਲੱਗ ਅਲੱਗ ਪੋਜ਼ 'ਤੇ ਫੋਟੋਆਂ ਖਿੱਚਣੀਆਂ ਪੈਂਦੀਆਂ ਹਨ ਅਤੇ ਰੀਲਾਂ ਅਤੇ ਫੋਟੋਆਂ ਨੂੰ ਅਸੀਂ ਇੱਕ ਦੂਜੇ ਦੇ ਵਿੱਚ ਕੰਪੇਅਰ ਕਰ ਨਹੀਂ ਸਕਦੇ ਕਿਉਂਕਿ ਦੋਨਾਂ ਦੇ ਵਿੱਚ ਵੱਖਰੇ ਵੱਖਰੇ ਕੰਮ ਹੁੰਦੇ ਹਨ ਅਤੇ ਫਿਰ ਉਸ ਤੋਂ ਬਾਅਦ ਮਤਲਬ ਇਹ ਮਤਲਬ ਕਿ ਜਿੱਦਾਂ ਕਿ ਮਤਲਬ ਰੀਲਾਂ ਚੱਲਣਾ ਪੈਂਦਾ ਅਤੇ ਫੋਟੋਆਂ ਵਿੱਚ ਖੜ੍ਹਣਾ ਪੈਂਦਾ ਅਤੇ ਮੈਨੂੰ ਰੀਲਾਂ ਦੇ ਵਿੱਚ ਜ਼ਿਆਦਾ ਮਤਲਬ ਇੰਟਰਸਟ ਆ ਅਤੇ ਮੈਂ ਆਪਣੀ ਆਈ ਡੀ 'ਤੇ ਰੀਲਾਂ ਹੀ ਮਤਲਬ ਡੇਲੀ ਜ਼ਿਆਦਾ ਪਾਉਂਦਾ ਹੈ ਅਤੇ ਫੋਟੋਆਂ ਤਾਂ ਬਹੁਤ ਘੱਟ ਪਾਉਂਦਾ ਹੈ ਮੈਨੂੰ ਰੀਲਾਂ ਬਣਾਉਣੀਆਂ ਬਹੁਤ ਚੰਗੀਆਂ ਲੱਗਦੀਆਂ ਹਨ